ਪਠਾਨਕੋਟ ਜ਼ਿਲ੍ਹੇ ਵਿੱਚ ਕਈ ਇਤਿਹਾਸਿਕ ਮਹੱਤਵ ਵਾਲੇ ਕਿਲੇ ਮੰਦਰ ਅਤੇ ਗੁਰਦੁਆਰੇ ਹਨ ਜੋ ਕਿ ਇਤਿਹਾਸ ਨਾਲ ਜੁੜੇ ਹੋਏ ਹਨ ਜਿਵੇਂ ਕਿ ਜਿਵੇਂ ਕਿ ਮੰਦਰ ਮਤੇਸ਼ਵਰ ਧਾਮ ਗੁਰਦੁਆਰਾ ਬਾਟ ਸਾਹਿਬ ਅਤੇ ਹੋਰ ਵੀ ਇਸ ਤੋਂ ਇਲਾਵਾ ਪਠਾਨਕੋਟ ਨੂੰ ਛੱਡ ਕੇ ਪੰਜਾਬ ਵਿੱਚ ਹੋਰ ਵੀ ਗੁਰਦੁਆਰੇ ਹਨ ਜੋ ਕਿ ਇਤਿਹਾਸ ਨਾਲ ਜੁੜੇ ਹਨ ਜਿਵੇਂ ਕਿ ਇੱਕ ਇਗਜਾਮਪਲ ਲੈ ਲਈਏ ਅਸੀਂ ਹਰਿਮੰਦਰ ਸਾਹਿਬ ਦੀ ਮੈਂ ਇਹਨਾਂ ਜਗ੍ਹਾ 'ਤੇ ਕਈ ਵਾਰ ਹੋ ਚੁੱਕ ਆਈ ਹਾਂ ਅਤੇ ਮੈਨੂੰ ਇੱਥੇ ਜਾਣਾ ਬਹੁਤ ਹੀ ਪਸੰਦ ਹੈ ਅਤੇ ਮੇਰਾ ਵਾਰ ਵਾਰ ਇਹਨਾਂ ਜਗ੍ਹਾ 'ਤੇ ਜਾਣ ਦਾ ਮਨ ਕਰਦਾ ਹੈ ਕਿਉਂਕਿ ਇਹ ਸਾਡੇ ਇਤਿਹਾਸ ਦਾ ਇਤਿਹਾਸ ਨੂੰ ਦੱਸਦੇ ਹਨ